ਨਹੀਂ ਜੀ ਅਸੀਂ ਬੀਮਾ ਕਵਰੇਜ ਤੋਂ ਬਿਲਕੁਲ ਵੀ ਖੁਸ਼ ਨਹੀਂ ਹੈ ਕਿਉਂਕਿ ਹਸਪਤਾਲਾਂ ਦੇ ਵਿੱਚ ਟੀ ਪੀ ਏ ਡਿਪਾਰਟਮੈਂਟ ਭਾਵ ਥਰਡ ਪਾਰਟੀ ਐਡਮਿਨਿਸਟਰੇਸ਼ਨ ਜਿਹੜੀ ਹੈ ਮਰੀਜ਼ ਦੇ ਬਿੱਲਾਂ ਅਤੇ ਹਸਪਤਾਲ ਦੇ ਬਿੱਲਾਂ ਅਤੇ ਹੋਰ ਖਰਚਿਆਂ ਦਾ ਹਿਸਾਬ ਕਿਤਾਬ ਰੱਖਦਾ ਹੈ ਅਸਲ ਵਿੱਚ ਹਸਪਤਾਲਾਂ ਦੇ ਬਿੱਲ ਅਦਾ ਕਰਨ ਲਈ ਕਰਵਾਈ ਇੰਸ਼ੋਰੈਂਸ ਦਾ ਪ੍ਰੋਸੈਸ ਬਹੁਤ ਹੀ ਖੱਜਲ ਖੁਆਰੀ ਵਾਲਾ ਹੁੰਦਾ ਹੈ ਜ਼ਿਆਦਾਤਰ ਆਮ ਜਨਤਾ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਮਾਮਲੇ ਵਿੱਚ ਉਹਨਾਂ ਨੂੰ ਪੂਰੀ ਜਾਣਕਾਰੀ ਹੁੰਦੀ ਨਹੀਂ ਹੈ ਅਤੇ ਇਸ ਕਰਕੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਜੇਕਰ ਤਾਂ ਸੰਬੰਧਿਤ ਹਸਪਤਾਲ ਦਾ ਇਨਕਮ ਟੈਕ ਇੰਸ਼ੋਰੈਂਸ ਕੰਪਨੀ ਨਾਲ ਟਾਈ ਅਪ ਹੈ ਫਿਰ ਤਾਂ ਕੁਝ ਨਾ ਕੁਝ ਮਦਦ ਭਾਵੇਂ ਮਿਲ ਜਾਵੇ ਪਰ ਜੇ ਅਜਿਹਾ ਨਾ ਹੋਵੇ ਤਾਂ ਬਹੁਤ ਸਮੱਸਿਆ ਹੁੰਦੀ ਹੈ ਇਸ ਸੰਬੰਧੀ ਸਰਕਾਰ ਨੂੰ ਮਰੀਜ਼ ਲਈ ਪੂਰੀ ਦਿੱਤੀ ਸਹਾਇਤਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਇੰਸ਼ੋਰੈਂਸ ਕੰਪਨੀ ਦੁਆਰਾ ਪੋਲਿਸੀ ਲੈਣ ਵੇਲੇ ਪਹਿਲਾਂ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਅਕਸਰ ਅਧੂਰੀ ਹੁੰਦੀ ਹੈ ਜਾਂ ਕਹਿ ਲਓ ਆਮ ਬੰਦੇ ਦੀ ਸਮਝ ਤੋਂ ਬਾਹਰ ਹੁੰਦੀ ਹੈ ਉਹਨਾਂ ਨੂੰ ਟਰਮਸ ਅਤੇ ਕੰਡੀਸ਼ਨ ਜਿਹੜੀਆਂ ਆ ਸਹੀ ਤਰ੍ਹਾਂ ਜਾਣਕਾਰੀ ਨਹੀਂ ਹੁੰਦੀ ਅਤੇ ਵਿਅਕਤੀ ਉਲਝ ਜਾਂਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਕੰਪਨੀਆਂ ਨੂੰ ਸਹੀ ਤਰੀਕੇ ਨਾਲ ਇੰਸ਼ੋਰੈਂਸ ਹੋਲਡਰ ਨੂੰ ਜਾਣਕਾਰੀ ਦੇਣ ਦੀ ਹਦਾਇਤ ਕਰਨ